ਹਾਂਜੀ ਜੇਕਰ ਆਪਣੀਆਂ ਪੁਰਾਣੀਆਂ ਯਾਦਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਮਨੁੱਖ ਨਾਲ਼ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ ਇਸੇ ਤਰ੍ਹਾਂ ਮੇਰੇ ਨਾਲ਼ ਵੀ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ ਮੈਂ ਜੋ ਵੀ ਖੇਡਾਂ ਖੇਡਦਾ ਹੁੰਦਾ ਸੀ ਉਹਨਾਂ ਦੀਆਂ ਮੇਰੇ ਨਾਲ਼ ਬਹੁਤ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਮੇਰੇ ਪੁਰਾਣੇ ਘਰ ਦੀਆਂ ਵੀ ਮੇਰੇ ਨਾਲ਼ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ ਸੋ ਮੈਂ ਉਹਨਾਂ ਯਾਦਾਂ ਨੂੰ ਬਹੁਤ ਵਾਰ ਮਿੱਸ ਕਰਦਾ ਹਾਂ